ਅੱਜ ਕੱਲ੍ਹ ਜੋ ਸਮਾਂ ਹੈ ਇਹ ਟੈਕਨੋਲੋਜੀ ਦਾ ਸਮਾਂ ਹੈ ਹਰ ਕਿਸੇ ਕੋਲ ਸਮਾਰਟਫੋਨ ਹੈ ਸਮਾਰਟਫੋਨ ਵਿੱਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਐਪਾਂ ਜਿਵੇਂ ਕਿ ਇੰਸਟਾਗਰਾਮ ਫੇਸਬੁੱਕ ਯੂਟਿਊਬ ਟਵਿੱਟਰ ਟੈਲੀਗਰਾਮ ਸਨੈਪਚੈਟ ਵੱਟਸਐਪ ਹਨ ਇਹਨਾਂ ਐਪਾਂ ਬਿਨਾ ਜੇ ਸੋਚਿਆ ਜਾਵੇ ਤਾਂ ਬੰਦੇ ਦਾ ਇੱਕ ਮਿੰਟ ਵੀ ਨਹੀਂ ਸਰਦਾ ਅੱਜ ਕੱਲ੍ਹ ਕੰਮ ਵੀ ਇਹਨਾਂ ਐਪਾਂ ਤੋਂ ਹੀ ਹੁੰਦੇ ਹਨ ਅਤੇ ਨਿਊਜ਼ ਦਾ ਅਪਡੇਟ ਵੀ ਇੱਥੋਂ ਹੀ ਜਲਦੀ ਤੋਂ ਜਲਦੀ ਮਿਲਦਾ ਹੈ ਫਾਇਦੇ ਦੇ ਨਾਲ ਸਮਾਰਟਫੋਨ ਦੇ ਬਹੁਤ ਸਾਰੇ ਨੁਕਸਾਨ ਵੀ ਹਨ ਜਿਵੇਂ ਕਿ ਕੁਝ ਲੋਕ ਅਸ਼ਲੀਲ ਵੀਡੀਓ ਜਾਂ ਕੰਮ ਸਮਾਰਟਫੋਨ ਤੋਂ ਹੀ ਕਰਦੇ ਹਨ ਅਤੇ ਸਮਾਰਟਫੋਨ ਯੂਜ ਕਰਦੇ ਟਾਈਮ ਬੰਦੇ ਨੂੰ ਬੇਰੁਜ਼ਗਾਰੀ ਦਾ ਵੀ ਅਹਿਸਾਸ ਨਹੀਂ ਹੁੰਦਾ ਉੱਦਾਂ ਟਾਈਮ ਪਾਸ ਫੋਨ 'ਤੇ ਹੀ ਹੁੰਦਾ ਰਹਿੰਦਾ ਹੈ